ਜਲੰਧਰ ਦੀ ਖੁਸ਼ਗਵਾਰ ਮੌਸਮ ਦਾ ਇਨਸਾਨੀ ਜੀਵਨ ਵਿੱਚ ਖਾਸ ਮਹੱਤਵ ਹੈ ਪੰਜਾਬੀਆਂ ਦਾ ਸਿਹਤਮੰਦ ਹੋਣਾ ਇੱਥੋਂ ਦੇ ਪੌਣ ਪਾਣੀ ਅਤੇ ਜਲਵਾਯੂ ਕਾਰਨ ਹੈ ਆਕਾਸ਼ ਜਲ ਪ੍ਰਿਥਵੀ ਅਤੇ ਅਗਨੀ ਦੁਆਰਾ ਹੀ ਬਿਨਾਂ ਦਵਾਈ ਦੇ ਪ੍ਰਯੋਗ ਕੀਤੀਆਂ ਅਸੀਂ ਸਿਹਤਮੰਦ ਨਿਰੋਗੀ ਅਤੇ ਤੰਦਰੁਸਤ ਜੀਵਨ ਜਿਊ ਸਕਦੇ ਹਾਂ ਜਲਵਾਯੂ ਪੱਖੋ ਪੰਜਾਬ ਭਾਰਤ ਦਾ ਇੱਕ ਮਹੱਤਵਪੂਰਨ ਸੂਬਾ ਹੈ ਅਤੇ ਜਲੰਧਰ ਉਸਦਾ ਇੱਕ ਬਹੁਤ ਖਾਸ ਜ਼ਿਲ੍ਹਾ ਹੈ ਇੱਥੇ ਮੌਸਮ ਸਮੇਂ ਸਮੇਂ 'ਤੇ ਅਨੇਕ ਰੰਗ ਬਦਲਦਾ ਹੈ ਜਲੰਧਰ ਵਿੱਚ ਬਦਲਦੇ ਮੌਸਮ ਨਾਲ ਗਰਮੀ ਅਤੇ ਸਰਦੀ ਦੀਆਂ ਰੁੱਤਾਂ ਦੇ ਨਾਲ ਨਾਲ ਬਸੰਤ ਰੁੱਤ ਪਤਝੜ ਰੁੱਤ ਵਰਖਾ ਰੁੱਤ ਅਤੇ ਸ਼ੀਤ ਰੁੱਤ ਸਮੇਤ ਕੁੱਲ ਛੇ ਰੁੱਤਾਂ ਵਾਰੋ ਵਾਰੀ ਆਉਂਦੀਆਂ ਹਨ ਬਸੰਤ ਰੁੱਤ ਪੰਜਾਬ ਦੀਆਂ ਰੁੱਤਾਂ ਵਿੱਚ ਸਭ ਤੋਂ ਹਰਮਨ ਪਿਆਰੀ ਅਤੇ ਸੁਹਾਵਣੀ ਰੁੱਤ ਹੈ ਬਸੰਤ ਰੁੱਤ ਵਿੱਚ ਅੰਬਾ ਨੂੰ ਬੂਰ ਪੈਣ ਅਤੇ ਕੋਇਲ ਕੂ ਕੂ ਕਰਕੇ ਕਾਇਨਾਤ ਨੂੰ ਹੋਰ ਵੀ ਖੁਸ਼ਨੁਮਾ ਬਣਾ ਦਿੰਦੀ ਹੈ ਗਰਮੀ ਦੇ ਰੁੱਤ ਬਾਕੀ ਦੀਆਂ ਰੁੱਤਾਂ ਦੇ ਮੁਕਾਬਲੇ ਜ਼ਿਆਦਾ ਤੱਤੀ ਮੰਨੀ ਜਾਂਦੀ ਹੈ ਵਰਖਾ ਰੁੱਤ ਹਾੜ੍ਹ ਮਹੀਨੇ ਦੇ ਖਤਮ ਹੋਣ ਮਗਰੋਂ ਸ਼ੁਰੂ ਹੁੰਦਿਆਂ ਹੀ ਸ਼ੁਰੂ ਹੋ ਜਾਂਦੀ ਹੈ ਬਿਮਾਰੀਆਂ ਅਕਸਰ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਡਾਇਰੀਆ ਮਲੇਰੀਆ ਹੈਜਾ ਜਿੱਥੇ ਬਿਮਾਰੀਆਂ ਖਾਸ ਤੌਰ 'ਤੇ ਫੈਲਦੀਆਂ ਹਨ ਵਰਖਾ ਰੁੱਤ ਲੰਘਣ ਮਗਰੋਂ ਸਰਦ ਰੁੱਤ ਆਉਂਦੀ ਹੈ ਇਸ ਰੁੱਤ ਵਿੱਚ ਚੜ੍ਹਦੇ ਸੂਰਜ ਦੀ ਨਿੱਘੀ ਨਿੱਘੀ ਧੁੱਪ ਸਰੀਰ ਅੰਦਰ ਮਿੱਠਾ ਮਿੱਠਾ ਨਿੱਘ ਦਿੰਦੀ ਹੈ ਪੱਤਝੜ ਤੋਂ ਬਾਅਦ ਪੱਤਿਆਂ ਦੇ ਝੜਨ ਦੀ ਰੁੱਤ ਪਰ ਪੱਤਾ ਝੜੇ ਰੁੱਖਾਂ ਦੇ ਨਵੇਂ ਕੋਮਲ ਪੱਤਿਆਂ ਨਾਲ ਕੁਦਰਤ ਨੂੰ ਨਵੇ ਨਵੇਲੀ ਦੁਲਹਨ ਵਾਂਗ ਸਜਾਉਣ ਲਈ ਵੀ ਪਤਝੜ ਰੁੱਤ ਨੂੰ ਉਦਾਸ ਰੁੱਤ ਨਹੀਂ ਕਿਹਾ ਜਾ ਸਕਦਾ ਮਾਘ ਅਤੇ ਫੱਗਣ ਦੇ ਮਹੀਨੇ ਵਿਚਕਾਰ ਦੀ ਰੁੱਤ ਸ਼ੀਤ ਰੁੱਤ ਅਖਵਾਉਂਦੀ ਹੈ ਇਸ ਰੁੱਤ ਵਿੱਚ ਹੱਡਾਂ ਨੂੰ ਠਾਰਨ ਵਾਲੀ ਠੰਢ ਪੈਂਦੀ ਹੈ